ਸਵੇਰੇ ਮੈਂ ਐਕਸਰਸਾਈਜ਼ ਕਰਦੀ ਹਾਂ ਰਨਿੰਗ ਕਰਦੀ ਹਾਂ ਮਤਲਬ ਇਸ ਨਾਲ ਮਤਲਬ ਮੇਰਾ ਸਾਰਾ ਦਿਨ ਵਧੀਆ ਰਹਿੰਦਾ ਆ ਮੇਰੀ ਬਾਡੀ ਸ਼ੇਪ 'ਚ ਆਈ ਹੈ ਮਤਲਬ ਬਹੁਤ ਫਿੱਟ ਰਹਿੰਦੀ ਹਾਂ ਮਤਲਬ ਕੋਈ ਪ੍ਰੋਬਲਮ ਨਹੀਂ ਕੋਈ ਬਿਮਾਰੀ ਨਹੀਂ ਸਿਹਤ ਵਧੀਆ ਰਹਿੰਦੀ ਹੈ ਸਾਰਾ ਦਿਨ ਖੁਸ਼ ਖੁਸ਼ ਰਹਿੰਦੀ ਹਾਂ ਮਤਲਬ ਇੱਕ ਬਹੁਤ ਵਧੀਆ ਉਹ ਹੈ ਵੀ ਐਨਰਜੀ ਆਉਂਦੀ ਆ ਮਤਲਬ ਵੀ ਮਨ ਖੁਸ਼ ਰਹਿੰਦਾ ਹਰ ਵਕਤ ਹਰ ਵਕਤ ਪੋਜੀਟਿਵ ਹੀ ਰਹਿੰਦੀ ਹੈ ਮਤਲਬ ਸਿਹਤ ਵਧੀਆ ਰਹਿੰਦੀ ਆ ਸਾਰਾ ਕੁਛ ਐਨ ਵਧੀਆ ਰਹਿੰਦਾ ਕੋਈ ਤਕਲੀਫ ਨਹੀਂ ਸਰੀਰ ਨੂੰ ਵਧੀਆ ਐਨ ਫਿਟ ਫਿਟ ਰਹਿੰਦਾ ਸਰੀਰ ਤੰਦਰੁਸਤ ਰਹਿੰਦਾ ਕੋਈ ਬਿਮਾਰੀ ਨਹੀਂ ਹੈਗੀ ਐਕਸਰਸਾਈਜ਼ ਕਰਨ ਨਾਲ ਸਾਨੂੰ ਬਹੁਤ ਵਧੀਆ ਲੱਗਦਾ ਹਮੇਸ਼ਾਂ ਐਕਸਰਸਾਈਜ਼ ਕਰਨੀ ਚਾਹੀਦੀ ਹੈ ਮਤਲਬ ਐਕਸਰਸਾਈਜ਼ ਨਾਲ ਜੋ ਵੀ ਕੋਈ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਸਰੀਰ ਦੀ ਉਹ ਠੀਕ ਹੁੰਦੀ ਹੈ ਮਤਲਬ ਵਾਤਾਵਰਨ ਸਾਰਾ ਖੁਸ਼ ਲੱਗਦਾ ਰਹਿੰਦਾ ਹਰ ਇੱਕ ਚੀਜ਼ ਆਪਾਂ ਨੂੰ ਵਧੀਆ ਲੱਗਦੀ ਹੈ ਹੈਪੀਨੈਸ ਰਹਿੰਦੀ ਹੈ ਸੋ ਇਸ ਲਈ ਆਪਾਂ ਨੂੰ ਐਕਸਰਸਾਈਜ਼ ਵਰਕ ਆਊਟ ਯੋਗਾ ਸਭ ਕੁਛ ਕਰਨਾ ਚਾਹੀਦਾ ਮੈਂ ਆਪਣੇ ਰੂਟੀਨ 'ਚ ਯੋਗਾ ਕਰਦੀ